ਮੈਂ ਮਲੋਟ ਦੀ ਧੂੜੀ ਇਲੈਕਟਰੋਨਿਕਸ ਤੋਂ ਇੱਕ ਲੈਪਟੋਪ ਬਾਏ ਕੀਤਾ ਸੀਗਾ ਉਹਦੇ ਵਿੱਚ ਕੀ ਸੀ ਮੈਂ ਲੈਪਟੋਪ ਦੇ ਸਾਰੇ ਫੀਚਰਸ ਦੇਖੇ ਪਹਿਲਾਂ ਮੈਂ ਔਨਲਾਈਨ ਮੰਗਵਾਇਆ ਸੀਗਾ ਔਨਲਾਈਨ ਦੇ ਵਿੱਚ ਉਹ ਲੈਪਟੋਪ ਬਹੁਤ ਵਧੀਆ ਆਇਆ ਮੇਰਾ ਫਿਰ ਮੈਨੂੰ ਉਸ ਦੇ ਨਾਲ ਦਾ ਇੱਕ ਹੋਰ ਲੈਪਟਾਪ ਚਾਹੀਦਾ ਸੀ ਤਾਂ ਮੈਂ ਕੀ ਕੀਤਾ ਮੈਂ ਸੇਮ ਲੈਪਟੋਪ ਮੈਂ ਧੂੜੀ ਇਲੈਕਟਰੋਨਿਕਸ ਦੇ ਵਿੱਚ ਜਾ ਕੇ ਮੈਂ ਉੱਥੋਂ ਖਰੀਦਿਆ ਪਰ ਉਹ ਲੈਪਟੋਪ ਦੇ ਵਿੱਚ ਫੀਚਰਸ ਬਹੁਤ ਗਲਤ ਸੀਗੇ ਜੋ ਵੀ ਫੀਚਰ ਸੀ ਮੈਮਰੀ ਵੀ ਉਸ ਦੀ ਘੱਟ ਸੀ ਉਹਨਾਂ ਨੇ ਪੈਸੇ ਮੇਰੇ ਤੋਂ ਉੰਨੇ ਹੀ ਲਿੱਤੇ ਤਾਂ ਮੈਂ ਹੁਣ ਕੀ ਕਹਿਣਾ ਚਾਹੁੰਦੀ ਹਾਂ ਕਿ ਦੁਕਾਨ ਵਾਲਿਆਂ ਨੂੰ ਕੀ ਮੇਰਾ ਜੋ ਲੈਪਟੋਪ ਹੈ ਉਹ ਜਾ ਤਾਂ ਮੈਨੂੰ ਰਿਪਲੇਸ ਕਰਕੇ ਦਿੱਤਾ ਜਾਵੇ ਮੈਨੂੰ ਮੇਰਾ ਲੈਪਟੋਪ ਸਹੀ ਹੀ ਚਾਹੀਦਾ ਹੈ ਮੈਨੂੰ ਸਹੀ ਲੈਪਟੋਪ ਦਿੱਤਾ ਜਾਵੇ ਸੇਮ ਮੇਰੇ ਮੈਮਰੀ ਦੇ ਨਾਲ ਦਿੱਤਾ ਜਾਵੇ ਉਸ ਦਾ ਕੈਮਰਾ ਵੀ ਕਲੀਅਰ ਨਹੀਂ ਹੈ ਨਵਾਂ ਲੈਪਟੋਪ ਸੀਗਾ ਪਰ ਉਹਦੇ ਸਾਰੇ ਪਾਰਟਸ ਖਰਾਬ ਹੈਗੇ ਹੈ ਤਾਂ ਉਹ ਕੀ ਹੈ ਉਹ ਕਿਸੇ ਵੀ ਵਰਤੋਂ ਦੇ ਵਿੱਚ ਨਹੀਂ ਆਊਗਾ ਸੱਠ ਹਜ਼ਾਰ ਰੁਪਏ ਦਾ ਇੱਕ ਲੈਪਟੋਪ ਸੀ ਮੈਨੂੰ ਉਹ ਲੈਪਟੋਪ ਦੇ ਪੈਸੇ ਜਾਂ ਤਾਂ ਵਾਪਿਸ ਕੀਤੇ ਜਾਣ ਜਾਂ ਫਿਰ ਮੈਨੂੰ ਉਸ ਦੇ ਬਦਲੇ ਇੱਕ ਨਵਾਂ ਲੈਪਟੋਪ ਸੇਮ ਉਸ ਹੀ ਹੀ ਰੈਮ 'ਚ ਦਿੱਤਾ ਜਾਵੇ ਅਤੇ ਮੋਡਲ ਉਹਨਾਂ ਦਾ ਸੇਮ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਲੈਪਟੋਪ ਵਾਪਿਸ ਨਹੀਂ ਮੇਰਾ ਕਰ ਸਕਦੇ ਤਾਂ ਮੈਨੂੰ ਮੇਰੇ ਪੈਸੇ ਵਾਪਿਸ ਕੀਤੇ ਜਾਣ ਅਤੇ ਮੇਰਾ ਮੇਰੇ ਪੈਸੇ ਅੱਜ ਹੀ ਮੈਨੂੰ ਵਾਪਿਸ ਕੀਤੇ ਜਾਣ